ਮਹੱਤਵਪੂਰਨ ਇਤਿਹਾਸਿਕ ਘਟਨਾਵਾਂ ਬਾਰੇ ਮੈਂ ਥੋੜ੍ਹੀ ਚਾਨਣਾ ਪਾਉਣਾ ਚਾਹੁੰਦਾ ਸਾਡੇ ਇਲਾਕੇ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਥਾਂ ਨੇ ਥਾਵਾਂ ਨੇ ਜਿੱਥੇ ਕਿ ਬਹੁਤ ਸਾਰੇ ਇਤਿਹਾਸਿਕ ਚੀਜ਼ਾਂ ਨੇ ਪਰ ਮੈਂ ਉਹਨਾਂ 'ਚੋਂ ਦੋ ਜਾਂ ਚਾਰ ਦੇ ਨਾਮ ਲੈਣਾ ਚਾਹੂੰਗਾ ਜਿਵੇਂ ਕਿ ਸਾਡੇ ਲਾਗੇ ਹੈਗਾ ਪਿੰਡ ਦੇ ਪੁਲਾੜਾ ਸਾਹਿਬ ਉੱਥੇ ਕਈ ਮਿਥਿਹਾਸਕ ਅਤੇ ਮਿਥਿਹਾਸਕ ਅਤੇ ਇਤਿਹਾਸਿਕ ਕਹਾਣੀਆਂ ਨੇ ਮੈਂ ਸੁਣਿਆ ਹੈ ਕਿ ਮਹਾਂਭਾਰਤ ਦੇ ਜਾਂ ਸ਼੍ਰੀ ਰਾਮ ਚੰਦਰ ਜੀ ਉੱਥੇ ਆਏ ਹੋਏ ਸੀਗੇ ਅਤੇ ਉੱਥੋਂ ਉਹਨਾਂ ਨੇ ਯਾਤਰਾ ਕਰਦੇ ਹੋਏ ਉੱਥੇ ਉਹਨਾਂ ਨੇ ਕੁਝ ਵਕਤ ਬਿਤਾਇਆ ਸੀ ਅਤੇ ਦੂਜੀ ਇਤਿਹਾਸ ਘਟਨਾ ਹੈਗੀ ਸਾਡੇ ਲਾਗੇ ਗੁਰਦੁਆਰਾ ਸਾਹਿਬ ਸ਼੍ਰੀ ਗੁਰਦੁਆਰਾ ਸ਼੍ਰੀ ਅੜੀਸਰ ਸਾਹਿਬ ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਮੈਂ ਸੁਣਿਆ ਹੈ ਆਏ ਸੀ ਪਦਾਰੇ ਸੀ ਅਤੇ ਉੱਥੇ ਉਹਨਾਂ ਦਾ ਘੋੜਾ ਵੀ ਉਹਨਾਂ ਨੇ ਬੰਨ੍ਹਿਆ ਸੀ ਅਤੇ ਅੱਗੇ ਨਹੀਂ ਸੀ ਵਧਿਆ ਅਤੇ ਇਹ ਹੀ ਦੋ ਤਿੰਨ ਇਤਿਹਾਸਿਕ ਸੰਸਥਾਵਾਂ ਨੇ ਥਾਵਾਂ ਨੇ ਜਗ੍ਹਾਵਾਂ ਨੇ ਅਤੇ ਹੋਰ ਵੀ ਬਹੁਤ ਨੇ ਪਰ ਇੰਨੇ ਲਈ ਹਜੇ ਇੰਨਾ ਹੀ ਕਾਫੀ ਨੇ ਥੈਂਕ ਜੂ ਜੀ